ਹੈਲੋ ਜੀ ਮੈਂ ਵੀਰ ਨਮਸਕਾਰ ਜੀ ਮੈਂ ਜੀ ਕੱਲ੍ਹ ਪਰਸੋਂ ਤੁਹਾਡੀ ਦੁਕਾਨ 'ਤੇ ਆਇਆ ਸੀ ਤੁਹਾਨੂੰ ਯਾਦ ਹੀ ਨਹੀਂ ਹੋਣਾ ਵੈਸੇ ਤਾਂ ਹਾਂਜੀ ਅਤੇ ਮੈਂ ਤੁਹਾਨੂੰ ਜੀ ਐਨਕ ਦੇ ਗਿਆ ਸੀ ਬਣਾਉਣ ਨੂੰ ਅਤੇ ਤੁਸੀਂ ਐਨਕ ਦੇ ਬਣਾਈ ਹੈ ਅਤੇ ਤੁਸੀਂ ਭੇਜ ਵੀ ਦਿੱਤੀ ਪਰ ਉਹ ਐਨਕ ਤਾਂ ਹੈ ਹੀ ਨਹੀਂ ਉਹ ਵਾਲੀ ਜਿਹੜੀ ਮੈਂ ਤੁਹਾਨੂੰ ਕਹੀ ਸੀ ਨਹੀਂ ਨਹੀਂ ਤੁਸੀਂ ਉਹਦੀ ਜੀ ਜਦੋਂ ਪੈਕਿੰਗ ਕੀਤੀ ਸੀ ਉਦੋਂ ਉਹਦੀ ਪੈਕਿੰਗ ਕਰਕੇ ਧਿਆਨ ਦਿੱਤਾ ਸੀ ਕਿ ਉਹ ਕਿਵੇਂ ਹੈਗੀ ਹੈ ਠੀਕ ਹੈ ਨਹੀਂ ਹੈ ਉਹ ਨਹੀਂ ਜੀ ਨਹੀਂ ਉਹ ਤਾਂ ਠੀਕ ਉਹ ਜਦੋਂ ਮੇਰੇ ਤੱਕ ਆਈ ਅਤੇ ਮੇਰੇ ਤੱਕ ਪਹੁੰਚੀ ਉਦੋਂ ਤੱਕ ਤਾਂ ਉਹ ਟੁੱਟ ਕੇ ਜੀ ਚੂਰ ਹੋ ਗਈ ਉਹ ਉਹ ਇਹ ਉਹ ਉਹ ਹੀ ਤਾਂ ਮੈਂ ਕਹਿੰਦੀ ਹਾਂ ਨਾ ਹਾਂਜੀ ਇਹ ਉਹ ਹੀ ਤਾਂ ਮੈਂ ਕਹਿੰਦੀ ਹਾਂ ਇਹ ਕਿਵੇਂ ਹੋ ਸਕਦਾ ਉੱਤੋਂ ਫਿਰ ਉਹ ਹੀ ਗੱਲ ਚਲੋ ਟੁੱਟ ਗਈ ਜਿਹੜੀ ਟੁੱਟ ਗਈ ਅਤੇ ਮੈਂ ਤੁਹਾਨੂੰ ਜਿਹੜੀ ਐਨਕ ਕਹੀ ਤੁਸੀਂ ਉਹ ਤਾਂ ਬਣਾਈ ਨਹੀਂ ਉਹਦੇ ਹੈਂਡਲ ਵੀ ਟੁੱਟੇ ਹੋਏ ਉਹਦਾ ਜੀ ਸ਼ੀਸ਼ਾ ਵੀ ਟੁੱਟ ਗਿਆ ਮੈਂ ਬਾਅਦ 'ਚ ਚਲੋ ਟੁੱਟੇ ਸ਼ੀਸ਼ੇ ਨੂੰ ਮੈਂ ਚੈੱਕ ਕਰ ਲਿਆ ਉਹ ਸ਼ੀਸ਼ਾ ਹੈ ਹੀ ਨਹੀਂ ਜਿਹੜਾ ਮੈਂ ਤੁਹਾਨੂੰ ਕਹਿ ਕੇ ਗਿਆ ਸੀ ਜੀ ਮੈਂ ਤੁਹਾਨੂੰ ਦੂਜੇ ਉਹ ਪ੍ਰੋਟੈਕਟਰ ਵਾਲੇ ਤੁਸੀਂ ਮੈਨੂੰ ਨਹੀਂ ਵਿਖਾਏ ਸੀ ਜਿਹੜੇ ਤੁਸੀਂ ਮੈਨੂੰ ਇੱਕ ਵਿ ਇੱਕ ਤਾਂ ਪਹਿਲਾਂ ਵਿਖਾਏ ਉਸ ਤੋਂ ਬਾਅਦ ਤੁਸੀਂ ਮੈਨੂੰ ਦੂਜੇ ਵਿਖਾਏ ਵਧੀਆ ਵਾਲੇ ਮੈਂ ਤੁਹਾਨੂੰ ਵਧੀਆ ਵਾਲੇ ਕਹੇ ਸੀ ਅਤੇ ਤੁਸੀਂ ਪਹਿਲੇ ਵਾਲੇ ਪਾ ਤੇ ਉਹਦੇ ਵਿੱਚ ਅਤੇ ਉਹ ਨਹੀਂ ਪਾਉਣੇ ਸੀ ਆਹ ਤੁਸੀਂ ਹਾਂਜੀ ਤੁਸੀਂ ਵੇਖੋ ਤੁਸੀਂ ਮੈਂ ਤੁਹਾਡੀ ਵੇਖ ਲਓ ਦੁਕਾਨ 'ਤੇ ਵਿਸ਼ਵਾਸ ਕਰਕੇ ਆਇਆ ਅਤੇ ਤੁਸੀਂ ਮੈਨੂੰ ਜਿੱਦਾਂ ਕਿਹਾ ਵੇਖ ਲਓ ਤੁਸੀਂ ਮੈਨੂੰ ਚੀਜ਼ਾਂ ਵਿਖਾਈਆਂ ਹਾਂਜੀ ਇਹ ਵਧੀਆ ਇਹ ਨਹੀਂ ਹੈਗੀ ਅਤੇ ਮੈਂ ਓਦਾਂ ਹੀ ਮੰਨਦਾ ਗਿਆ ਅਤੇ ਹਾਂ ਉਹਦਾ ਡਿਜ਼ਾਇਨ ਇੱਕ ਫਰੇਮ ਦਾ ਮੈਂ ਤੁਹਾਨੂੰ ਵਿਖਾਇਆ ਸੀ ਅਤੇ ਉਹ ਡਿਜ਼ਾਇਨ ਵੀ ਉਹ ਨਹੀਂ ਸੀ ਉਹ ਵੀ ਅਲੱਗ ਸੀ ਉਹਦਾ

ਨਹੀਂ ਉਹ ਹੁਣ ਚਲੋ ਹੋ ਗਈ ਹੁਣ ਉਹ ਇੱਕ ਵਾਰੀ ਦੇਵੀ ਵੇਖੋ ਆਪਣੇ ਪੈ ਗਿਆ ਨਾ ਥੱਲੇ ਤੁਹਾਨੂੰ ਵੀ ਦੁਬਾਰਾ ਕਰਨਾ ਪੈਣਾ ਜੇ ਅਤੇ ਹੁਣ ਮੇਰਾ ਵੀ ਕੰਮ ਵੱਧ ਗਿਆ ਜੇ ਇਸ ਚੱਕਰ 'ਚ

ਆ ਤੁਸੀਂ ਤੁਸੀਂ ਵੇਖੋ ਮੈਨੂੰ ਜਿੱਦਾਂ ਗਏ ਤੁਸੀਂ ਮੈਨੂੰ ਜਿੰਨੇ ਪੈਸੇ ਕਹੇ ਮੈਂ ਤੁਹਾਨੂੰ ਓਨੇ ਓਵੇਂ ਦੇ ਤੇ ਮੈਂ ਕਿਹਾ ਚਲੋ ਮੈਂ ਰੀਜ ਮੈਂ ਮੇਰੀ ਚੀਜ਼ ਬਣਾਉਣੀ ਸੀ ਮੈਨੂੰ ਪਸੰਦ ਆਈ ਸੀ ਤੁਹਾਡੀ ਦੁਕਾਨ ਉਤੇ ਮੈਂ ਉਸ ਤੋਂ ਪਹਿਲਾਂ ਚਾਰ ਦੁਕਾਨਾਂ ਹੋਰ ਜਾ ਕੇ ਆਇਆ ਸੀ ਮੈਨੂੰ ਉੱਥੇ ਕੁਝ ਨਹੀਂ ਪਸੰਦ ਆਇਆ ਤੁਹਾਡੇ ਦੁਕਾਨ 'ਤੇ ਮੈਨੂੰ ਪਸੰਦ ਹਾਂਜੀ ਸ਼ਾਇਦ ਉਹ ਹਾਂਜੀ ਬਸ ਕੋਈ ਮੈਨੂੰ ਲੱਗਦਾ ਸ਼ਾਇਦ ਇਹ ਗੱਲ ਹੋ ਗਈ ਕਿ ਮੈਂ ਤੁਹਾਨੂੰ ਹਾਂਜੀ ਉਹ ਹੀ ਤਾਂ ਕਹਿੰਦੀ ਹਾਂ ਨਾ ਸ਼ਾਇਦ ਮੈਂ ਲੱਗਦਾ ਕੋਈ ਇਹ ਗਲਤੀ ਹੋ ਗਈ ਕਿ ਵੀ ਮੈਂ ਜਿਵੇਂ ਮੰਨ ਲਓ ਤੁਹਾਨੂੰ ਸਾਰਾ ਕੁਝ ਦੱਸ ਕੇ ਗਿਆ ਅਤੇ ਅੱਗੋਂ ਸ਼ਾਇਦ ਬਣਾ ਕਿਸੇ ਹੋਰ ਨੇ ਦਿੱਤੀ ਉਹਨੇ ਧਿਆਨ ਨਹੀਂ ਦਿੱਤਾ ਕਿ ਮੈਂ ਦੱਸਿਆ ਕਿ ਪਲਸ ਵੇਖੋ ਤੁਸੀਂ ਜਿਹੜੀ ਡਿਲੀਵਰੀ ਕੀਤੀ ਹੈ ਉਹ ਡਿਲੀਵਰੀ ਕਰਦੇ ਕਰਦੇ ਚੀਜ਼ ਘਰ ਆਉਂਦੇ ਆਉਂਦੇ ਤੱਕ ਤਾਂ ਜਮਾਂ ਚੂਰ ਹੋ ਗਈ ਉਹ ਐਨਕ ਰਹੀ ਨਹੀਂ ਜੀ ਸਹੀ ਹਾਂਜੀ ਹਾਂਜੀ ਅਤੇ ਹੁਣ ਜੇ ਮੈਂ ਹੁਣ ਇਹਦੇ ਪੈਸੇ ਮੈਂ ਪਹਿਲੇ ਭਰ ਚੁੱਕਿਆ ਅਤੇ ਮੈਂ ਹੁਣ ਦੁਬਾਰਾ ਪੈਸੇ ਨਹੀਂ ਭਰਾਂਗਾ ਜੀ ਇਹਦੇ ਹਾਂਜੀ ਹਾਂਜੀ ਉਹ ਤਾਂ ਹੁਣ ਚਲੋ ਆਉਣਾ ਹੀ ਪਵੇਗਾ ਕਿਉਂਕਿ ਦੁਬਾਰਾ ਐਨਕ ਤਾਂ ਮੈਨੂੰ ਬਣਵਾਉਣੀ ਹੈ ਮੈਂ ਆਉਂਗਾ ਦੁਬਾਰਾ ਅਤੇ ਉਹ ਲੈ ਕੇ ਵੀ ਆਉਂਗਾ ਨਾਲ ਤੁਸੀਂ ਉਹਨੂੰ ਵੇਖਿਓ ਅਤੇ ਚੈੱਕ ਕਰਿਓ ਅਤੇ ਫਿਰ ਵੇਖ ਕੇ ਨਾ ਉਹ ਨਾ ਤੁਸੀੰ ਮੈਨੂੰ ਦੁਬਾਰਾ ਕਰਕੇ ਦਿਓ ਸਾਰਾ ਸਹੀ ਅਤੇ ਬਣਾ ਕੇ ਦਿਓ ਮੈਨੂੰ ਹਾਂਜੀ ਹਾਂਜੀ ਠੀਕ ਹੈ ਮੈਂ ਕੱਲ੍ਹ ਕੱਲ੍ਹ ਹੀ ਆਉਂਦਾ ਬਸ ਮੈਂ ਲੈ ਕੇ ਉਹਨੂੰ ਠੀਕ ਹੈ ਓਕੇ ਜੀ ਥੈਂਕ